ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਵਪ੍ਰੀਤ ਸਿੰਘ ਮੇਰੇ ਵੱਲੋਂ ਸੈਮਸੰਗ ਕੰਪਨੀ ਦਾ ਟੀ ਵੀ ਖਰੀਦਿਆ ਗਿਆ ਸੀਗਾ ਬੱਤੀ ਇੰਚ ਦਾ ਉਹਦੇ ਵਿੱਚ ਉਹ ਮੇਰਾ ਐਕਪਰੀਅੰਸ ਬਹੁਤ ਵਧੀਆ ਰਿਹਾ ਤੁਹਾਡੀ ਕੰਪਨੀ ਦਾ ਬੰਦਾ ਆ ਕੇ ਘਰੇ ਲਗਾ ਗਿਆ ਸੀਗਾ ਅਤੇ ਉਹ ਸਾਰਾ ਕੁਝ ਦੱਸ ਕੇ ਵੀ ਗਿਆ ਉਸ ਬਾਰੇ 'ਚ ਸਾਰੇ ਫੀਚਰ ਸਮਝਾ ਕੇ ਗਿਆ ਏ ਅਤੇ ਮੈਂ ਇਸ ਸੰਬੰਧੀ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਸੀ ਅਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਤੁਹਾਡਾ ਟੀ ਵੀ ਅਤੇ ਮੈਂ ਉਹਨਾਂ ਨੂੰ ਸਿਫ਼ਾਰਿਸ਼ ਕੀਤੀ ਹੈ ਵੀ ਉਹ ਤੁਹਾਡਾ ਥ ਮਤ ਸੈਮਸੰਗ ਕੰਪਨੀ ਦਾ ਹੀ ਟੀ ਵੀ ਲਵਾਉਣ ਅਤੇ ਉਹ ਤੁਹਾਡੀ ਤੁਹਾਡੇ ਨਾਲ਼ ਆ ਕੇ ਰਾਬਤਾ ਕਾਇਮ ਕਰਨਗੇ ਥੈਂਕ ਧੰਨਵਾਦ